ਜਿੱਥੇ ਹਰੇਕ ਰਾਜ ਵਿੱਚ ਖੇਡਾਂ ਖਿਡਾਈਆਂ ਜਾਂਦੀਆਂ ਉਹਨਾਂ ਦੇ ਵਿੱਚ ਖੇਡਾਂ ਦੇ ਨਾਲ ਨਾਲ ਉਹਨਾਂ ਦੇ ਖੇਡਾਂ ਦੇ ਵਿੱਚ ਹਿੰਸਾ ਨੂੰ ਰੋਕਣ ਲਈ ਬਹੁਤ ਸਾਰੇ ਕਾਨੂੰਨ ਲਾਗੂ ਕੀਤੇ ਜਾਂਦੇ ਹਨ ਇਹ ਕਾਨੂੰਨ ਅਲੱਗ ਅਲੱਗ ਤਰ੍ਹਾਂ ਦੇ ਹੁੰਦੇ ਹਨ ਇਹ ਖੇਡ ਦੇ ਹਿਸਾਬ ਨਾਲ ਕਾਨੂੰਨ ਲਾਗੂ ਕੀਤੇ ਜਾਂਦੇ ਹਨ ਜੇਕਰ ਅਸੀਂ ਕਬੱਡੀ ਦੀ ਗੱਲ ਕਰੀਏ ਕਬੱਡੀ ਦੇ ਵਿੱਚ ਵੀ ਕਈ ਸਾਰੇ ਕਾਨੂੰਨ ਲਾਗੂ ਕੀਤੇ ਜਾਂਦੇ ਹਨ ਕਿ ਤਾਂ ਕਿ ਕਬੱਡੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਹਿੰਸਾ ਨਾ ਹੋਵੇ ਤਾਂ ਸਾਰੇ ਖਿਡਾਰੀ ਵਧੀਆ ਤਰੀਕੇ ਨਾਲ ਆਪਣੀ ਖੇਡ ਖੇਡਣ ਕਬੱਡੀ ਦੇ ਵਿੱਚ ਕਹਿ ਸਕਦੇ ਹਨ ਇੱਕ ਇਸ ਤਰ੍ਹਾਂ ਦਾ ਰੋਲ ਹੁੰਦਾ ਹੈ ਕਿ ਜੇਕਰ ਤੁਹਾਡੀ ਟੀਮ ਇੰਨੇ ਟਾਈਮ ਤੋਂ ਬਾਅਦ ਖੇਡ ਗਰਾਊਂਡ ਦੇ ਅੰਦਰ ਐਂਟਰੀ ਕਰਦੀ ਹੈ ਤਾਂ ਤੁਹਾਡੀ ਟੀਮ ਡਿਸਕੁਆਲੀਫਾਈ ਹੋ ਜਾਏਗੀ ਤੁਹਾਡੀ ਟੀਮ ਦੇ ਵਿੱਚ ਕਿੰਨੇ ਮੈਂਬਰ ਹੁੰਦੇ ਹਨ ਉਹ ਵੀ ਕਾਨੂੰਨ ਦੇ ਰੂਪ ਵਿੱਚ ਡਿਸਾਈਡ ਕੀਤਾ ਜਾਂਦੇ ਹਨ ਤੁਹਾਡੀ ਟੀਮ ਦੇ ਵਿੱਚ ਕਿੰਨੇ ਬੰਦੇ ਰੈਫਰੀ ਹੋਣ ਕਿੰਨੇ ਬੰਦੇ ਜਾਫੀ ਹੋਣਗੇ ਕਿੰਨੇ ਬੰਦੇ ਰੇਡਰ ਹੋਣਗੇ ਇਹ ਵੀ ਸਾਰਾ ਕਾਨੂੰਨ ਦੇ ਰੂਪ ਵਿੱਚ ਹੀ ਡਸੀਜ਼ਨ ਲਿਆ ਜਾਂਦਾ ਹੈ ਅਤੇ ਹਰੇਕ ਖੇਡ ਮੇਲੇ ਵਿੱਚ ਹਰੇਕ ਤਰ੍ਹਾਂ ਦੀ ਖੇਡ ਦੇ ਦੌਰਾਨ ਇੱਕ ਦੋ ਪੁਲਿਸ ਕਰਮਚਾਰੀ ਉੱਥੇ ਮੌਜੂਦ ਹੁੰਦੇ ਹਨ ਤਾਂ ਕਿ ਕਿਸੇ ਵੀ ਤਰ੍ਹਾਂ ਦੇ ਹਿੰਸਾ ਹੋਣ ਦੇ ਸਮੇਂ ਉਹ ਉੱਥੇ ਦੇ ਮਾਹੌਲ ਨੂੰ ਕੰਟਰੋਲ ਕਰ ਸਕਣ